ਦੋ ਇੱਕ ਮਾਰਚ ਦੋ ਜ਼ੀਰੋ ਜ਼ੀਰੋ ਦੋ ਦੋ ਪੰਜ ਮਾਰਚ ਦੋ ਜ਼ੀਰੋ ਜ਼ੀਰੋ ਦੋ ਵਨ ਸਿਕਸ ਜੂਨ ਦੋ ਜ਼ੀਰੋ ਜ਼ੀਰੋ ਤਿੰਨ ਚਾਰ ਮਾਰਚ ਇੱਕ ਨੌਂ ਸੱਤ ਇੱਕ ਦੋ ਸੱਤ ਅਕਤੂਬਰ ਇੱਕ ਨੌਂ ਸੱਤ ਚਾਰ